ਜੀ ਬਿਲਕੁਲ ਅਸੀਂ ਗੇਮਿੰਗ ਕਮਿਊਨਿਟੀ ਦਾ ਹਿੱਸਾ ਰਹੇ ਹਾਂ ਬਚਪਨ ਵਿੱਚ ਅਸੀਂ ਸਾਰੇ ਦੋਸਤ ਮਿਲ ਕੇ ਇਕੱਠੇ ਹੋ ਕੇ ਗੇਮਸ ਖੇਡਨ ਲਈ ਮਿਲੀਦਾ ਸੀ ਅਤੇ ਅਸੀਂ ਗੇਮਸ ਖੇਡਦੇ ਹੁੰਦੇ ਸੀ ਮਿਲ ਮਿਲ ਕੇ ਅਤੇ ਉਹਨਾਂ 'ਚੋਂ ਸਭ ਸੋ ਜਿਹੜੀ ਵਧੀਆ ਗੇਮ ਸੀ ਅਤੇ ਉਹ ਸੀਗੀ ਖੋ ਖੋ ਅਤੇ ਅਸੀਂ ਸਾਰੇ ਖੋ ਖੋ ਖੇਡਦੇ ਸੀ ਜਿਸ 'ਚ ਸਾਡੇ ਜਿਹੜੇ ਯਾਰ ਬੇਲੀ ਸੀ ਅਸੀਂ ਦੋ ਗੁੱਟਾ 'ਚ ਹੋ ਜਾਂਦੇ ਸੀ ਅਤੇ ਇੱਕ ਲਿਵ ਵਿੱਚ ਸੈਂਟਰ 'ਚ ਆਪਾਂ ਇੱਕ ਉਹ ਬਣਾ ਲਈਦੀ ਸੀ ਲਾਈਨ ਖਿੱਚ ਲਈਦੀ ਸੀ ਅਤੇ ਜਿੱਦਾਂ ਪੰਜ ਜੇ ਲੋਕ ਇੱਧਰ ਨੇ ਇੱਕ ਸਾਈਡ 'ਤੇ ਅਤੇ ਪੰਜ ਦੂਜੀ ਸਾਈਡ 'ਤੇ ਅਤੇ ਉਹ ਐਕਸਪੀਰੀਅੰਸ ਉਹ ਅਨੁਭਵ ਬਹੁਤ ਵਧੀਆ ਰਹਿੰਦਾ ਸੀ ਕਿ ਇੱਕ ਬੰਦਾ ਇੱਕ ਟੀਮ 'ਚੋਂ ਨਿਕਲ ਕੇ ਦੂਜੀ ਟੀਮ ਜਾਣਾ ਹੁੰਦਾ ਸੀ ਅਤੇ ਉਹਨੇ ਸਾਰਿਆਂ ਨੂੰ ਹੱਥ ਲਾ ਕੇ ਅਤੇ ਫਿਰ ਬਿਨਾਂ ਫੜਵਾਏ ਆਪਣੇ ਆਪ ਨੂੰ ਵਾਪਸ ਆਉਣਾ ਹੁੰਦਾ ਸੀ ਅਤੇ ਉਹ ਇੱਕ ਬੜਾ ਵਧੀਆ ਐਕਸਪੀਰੀਅੰਸ ਸੀਗਾ ਉਹ ਤੁਹਾਨੂੰ ਜਦੋਂ ਤੁਸੀਂ ਇੱਦਾਂ ਦੀ ਗੇਮਸ ਖੇਡਦੇ ਹੋ ਤਾਂ ਉਦੋਂ ਤੁਹਾਨੂੰ ਇੱਕ ਪੂਰੀ ਸਪੋਰਟਮੈਨਸਿਪ ਦੀ ਸਪਿਰਿਟ ਆਉਂਦੀ ਹੈ ਤੁਹਾਡੇ ਅੰਦਰ ਤੁਸੀਂ ਜਿੱਤਦੇ ਹੋ ਤੁਸੀਂ ਹਾਰਦੇ ਹੋਏ ਵੀ ਦੇਖਦੇ ਹੋ ਆਪਣੇ ਆਪ ਅਤੇ ਤੁਹਾਨੂੰ ਉਸ ਟਾਈਮ ਸਭ ਕੁਛ ਹੈਂਡਲ ਕਰਨਾ ਆਉਂਦਾ ਹੈ ਕਿ ਜਿਹੜੀ ਮੈਂ ਉੱਥੋ ਇਹੀ ਸਿੱਖਿਆ ਉਸ ਅਨੁਭਵ ਤੋਂ ਕਿ ਜਿਹੜੀ ਇਹ ਜੀਤ ਹੈ ਅਤੇ ਹਾਰ ਹੈ ਉਹ ਦੋਨੋਂ ਇੱਕ ਗੇਮ ਦਾ ਹਿੱਸਾ ਹੈ ਬਿਲਕੁਲ ਸਾਡੇ ਜੀਵਨ ਬਕਣ ਗੇਮਸ ਸਿਰਫ ਗੇਮਸ ਨਹੀਂ ਹੁੰਦੀਆਂ ਬਿਲਕੁਲ ਸਾਡੇ ਜੀਵਨ ਵਰਗੀਆਂ ਹੁੰਦੀਆਂ ਕਿ ਜਿੱਤ ਹਾਰ ਤਾਂ ਲੱਗੀ ਹੀ ਰਹਿੰਦੀ ਹੈ ਅਤੇ ਨਾਲੇ ਉਹਦੇ ਨਾਲ ਸਾਡਾ ਸਰੀਰ ਵੀ ਫਿੱਟ ਰਹਿੰਦਾ